ਦਸ ਮਾਰਚ ਵੀਹ ਵੀਹ ਚੌਦਾਂ ਜਨਵਰੀ ਉੱਨੀ ਪੰਝੱਤਰ ਅਠਾਰਾਂ ਫਰਵਰੀ ਵੀਹ ਇੱਕੀ ਸੋਲਾਂ ਦਸੰਬਰ ਅਠਾਰਾਂ ਚਾਲੀ ਪੰਦਰਾਂ ਮਈ ਉੱਨੀ ਪੰਜਾਹ